ਹੈਲੋ ਸਤਿ ਸ੍ਰੀ ਅਕਾਲ ਜੀ ਆਪਣਾ ਤੁਸੀਂ ਗਰਗ ਟਿਕਟ ਬੁਕਿੰਗ ਸ਼ੌਪ ਤੋਂ ਗੱਲ ਕਰ ਰਹੇ ਹੋ ਅੱਛਾ ਹਾਂਜੀ ਹਾਂਜੀ ਹਾਂਜੀ ਅਸੀਂ ਨਾ ਬਰਨਾਲੇ ਤੋਂ ਬੋਲਦੇ ਸੀਗੇ ਜੀ ਹਾਂਜੀ ਅਸੀਂ ਨਾ ਪਲੈਨ ਕਰ ਰਹੇ ਸੀ ਪੂਰੀ ਫੈਮਿਲੀ ਨੇ ਜਾਣਾ ਗਾ ਅਸੀਂ ਹਜੂਰ ਸਾਹਿਬ ਜਾਣਾ ਸੀ ਯਾਤਰਾ ਦੇ ਲਈ ਅੱਛਾ ਹਾਂਜੀ ਅਸੀਂ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਜਾਣ ਦਾ ਪਲੈਨ ਕਰ ਰਹੇ ਹਾਂ ਜੀ ਵੀ ਚੱਲ ਦੋ ਚਾਰ ਛੁੱਟੀਆਂ ਲੈ ਲੈਣ ਪੱਚੀ ਤੋਂ ਛੁੱਟੀਆਂ ਹੋ ਜਾਂਦੀਆਂ ਇੱਕੀ ਕੁ ਤਾਰੀਕ ਤੋਂ ਪਲੈਨ ਕਰ ਰਹੇ ਸੀ ਵੀ ਹਜੂਰ ਸਾਹਿਬ ਸ਼ੀਰਡੀ ਉੱਥੇ ਅਸੀਂ ਸਾਰੇ ਕੀਤੇ ਜਾ ਕੇ ਆਉਣਾ ਗਾ ਸੋ ਸਾਰੀ ਹਾਂਜੀ ਹਾਂਜੀ ਸਾਰੀ ਫੈਮਿਲੀ ਨੇ ਅਸੀਂ ਹਾਂਜੀ ਹੈਗੇ ਹਾਂ ਵੀਹ ਕੁ ਜਾਣੇ ਹੈਗੇ ਜੀ ਵੀਹ ਜਾਣੇ ਹੈਗੇ ਬਾਕੀ ਬੱਚੇ ਹੈਗੇ ਬੱਚਿਆਂ ਦੀ ਉਮਰ ਜੀ ਹਾਂਜੀ ਪੰਜ ਸਾਲ ਤੋਂ ਘੱਟ ਹੈ ਜੀ ਚਾਰ ਬੱਚੇ ਹੈ ਸਾਡੇ ਨਾਲ ਪੰਜ ਸਾਲ ਅਤੇ ਹਾਂ ਸੀਨੀਅਰ ਸਿਟੀਜ਼ਨ ਵੀ ਹੈਗੇ ਨੇ ਸਾਡੇ ਨਾਲ ਪੰਜ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਅੱਛਾ ਹਾਂਜੀ ਮੇਲ ਫੀਮੇਲ ਸਾਡੇ ਵਿੱਚ ਹੈਗੀਆਂ ਪੰਜ ਠੀਕ ਹੈ ਜੀ ਹਾਂਜੀ ਸਾਨੂੰ ਨਾ ਆਪਣਾ ਸੈਕੰਡ ਏਸੀ ਕੋਚ ਚਾਹੀਦਾ ਹੈਗਾ ਅੱਛਾ ਮਿਲ ਜਾਊਗਾ ਜੀ ਠੀਕ ਹੈ ਅਤੇ ਸੀਟਾਂ ਮੈਨੂੰ ਇਹ ਦੱਸੋ ਜੀ ਸੀਟਾਂ ਦਾ ਇਹ ਕਨਫਰਮ ਕਰੋ ਇੱਕੇ ਹੀ ਵਿੱਚ ਮਿਲ ਜਾਣਗੇ ਸਾਨੂੰ ਅਲੱਗ ਅਲੱਗ ਮਿਲਣਗੀਆਂ ਅੱਛਾ ਠੀਕ ਹੈ ਜੀ ਜੇ ਵੀ ਇੰਨਾਂ ਹੋ ਸਕੇ ਵੀ ਇਨੀਸ਼ਲੀਆਂ ਸੀਟਾਂ ਹੀ ਸਾਨੂੰ ਇਹ ਪ੍ਰੋਵਾਈਡ ਹੋ ਜਾਣ ਪਲੀਜ਼ ਚੈਕ ਕਰੋ ਤੁਸੀਂ ਕਿਉਂਕਿ ਹਾਲੇ ਤਾਂ ਨਵੰਬਰ ਹੀ ਚੱਲ ਰਿਹਾ ਹੈਗਾ ਕਾਫੀ ਦਿਨ ਪਏ ਆ ਕੀ ਪਤਾ ਖਾਲੀ ਹੋਣ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਬਾਈ ਜੀ ਇੱਕ ਇਹ ਵੀ ਦੇਖੋ ਵੀ ਸਾਫ ਸਫਾਈ ਇਹਦੇ 'ਚ ਹੁੰਦੀ ਹੈ ਵਧੀਆ ਠੀਕ ਹੈ ਅੱਛਾ ਅੱਛਾ ਅਤੇ ਖਾਣਾ ਵਗੈਰਾ ਸਾਨੂੰ ਮਿਲੂਗਾ ਜੀ ਇੱਥੋਂ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਹਾਂਜੀ ਤੁਸੀਂ ਵੀਹ ਕਰ ਦਿਓ ਬਾਈ ਜੀ ਸਾਡੀਆਂ ਸੀਟਾਂ ਹਾਂਜੀ ਸਾਰੀਆਂ ਹੀ ਸੈਕਿੰਡ ਕੋਚ ਦੀਆਂ ਹੀ ਕਰਨੀਆਂ ਹੈਗੀਆਂ ਸੈਕਿੰਡ ਏਸੀ ਦੀਆਂ ਠੀਕ ਹੈ ਜੀ ਓਕੇ ਜੀ ਥੈਂਕ ਯੂ ਵੀਰੇ